ਵੈਸੇ ਜੇ ਦੇਖਿਆ ਜਾਵੇ ਕਿ ਸਾਡੇ ਜਦੋਂ ਮੈਂ ਆਪਣੇ ਅਕੋਡਿੰਗ ਦੱਸਦਾ ਹਾਂ ਮੇਰੇ ਅਨੁਸਾਰ ਕਿ ਮੈਂ ਇੱਕ ਵਾਰ ਹੀ ਗਿਆ ਸੀ ਰਾਸ਼ਟਰੀ ਪ੍ਰੀਖਿਆ ਦੇਣ ਜੋ ਕਿ ਫਤਿਹਗੜ੍ਹ ਸਾਹਿਬ ਸੀ ਅਤੇ ਉਸ ਦੀ ਤਿਆਰੀ ਮੈਂ ਖੁਦ ਆਪ ਕੀਤੀ ਸੀ ਅਤੇ ਨਾਲ ਕੁਝ ਟੀਚਰ ਨੇ ਕਰਵਾਈ ਸੀ ਅਤੇ ਅੱਜ ਕੱਲ੍ਹ ਰਾਸ਼ਟਰੀ ਮੁਕਾਬਲੇ ਦੀਆਂ ਪ੍ਰੀਖਿਆ ਦੇਣ ਲਈ ਬਹੁਤ ਸਾਰੀਆਂ ਸੰਸਥਾਵਾਂ ਖੁੱਲ੍ਹ ਗਈਆਂ ਹਨ ਜਿਨ੍ਹਾਂ ਵਿੱਚੋਂ ਆਪਾਂ ਟਿਊਸ਼ੀਅਨ ਲੈ ਕੇ ਪ੍ਰੀਖਿਆ ਲੈ ਸਕਦੇ ਹਾਂ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਮਦਦ ਕੁਝ ਇਸ ਤਰ੍ਹਾਂ ਕਰਦੀ ਹੈ ਕਿਉਂਕਿ ਜਦੋਂ ਵੀ ਆਪਾਂ ਟਿਊਸ਼ਨ ਲੈਂਦੇ ਹਾਂ ਤਾਂ ਉਹ ਆਪਾਂ ਨੂੰ ਹਰੇਕ ਚੀਜ਼ ਜੋ ਵੀ ਇਸ ਵਿੱਚ ਆਉਣੀ ਹੁੰਦੀ ਹੈ ਉਸ ਬਾਰੇ ਇਕੱਲਾ ਇਕੱਲਾ ਵਿਸਥਾਰ ਪੂਰਵਕ ਦੱਸ ਦਿੰਦੇ ਹਨ ਅਤੇ ਇਸ ਬਾਰੇ ਸਾਡੀ ਜਾਣਕਾਰੀ ਵਿੱਚ ਵਾਧਾ ਹੋ ਜਾਂਦਾ ਹੈ ਜੋ ਕਿ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਜਿਸ ਕਾਰਨ ਅਸੀਂ ਆਪਣੀ ਪ੍ਰੀਖਿਆ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਲੈ ਕੇ ਜਾ ਸਕਦੇ ਹਾਂ